ਮੈਂ ਫੋਟੋਗ੍ਰਾਫ਼ੀ ਨੂੰ ਇੱਕ ਪੇਸ਼ੇ ਵਜੋਂ ਲੈਣ ਬਾਰੇ ਸੋਚਿਆ ਸੀ ਕਿਉਂਕਿ ਇਸ ਵਿੱਚ ਅੱਗੇ ਦਾ ਖੇਤਰ ਬਹੁਤ ਹੀ ਵਧੀਆ ਹੈ ਅਤੇ ਇੱਕ ਫੋਟੋਗ੍ਰਾਫਰ ਮਹੀਨੇ ਦਾ ਬਹੁਤ ਹੀ ਵਧੀਆ ਖਰਚਾ ਕੱਢ ਲੈਂਦਾ ਹੈ ਕਿਉਂਕਿ ਅੱਜ ਕੱਲ੍ਹ ਵਿਆਹਵਾਂ ਸ਼ਾਦੀਆਂ ਵਿੱਚ ਫੋਟੋਗ੍ਰਾਫ਼ਰ ਹੀ ਜ਼ਿਆਦਾਤਰ ਹੁੰਦੇ ਹਨ ਫੋਟੋਗ੍ਰਾਫ਼ੀ ਦਾ ਕੰਮ ਬਹੁਤ ਹੀ ਵੱਧ ਚੁੱਕਾ ਹੈ ਹਰ ਕੋਈ ਫੋਟੋਗ੍ਰਾਫ਼ੀ ਦਾ ਕੰਮ ਹੀ ਕਰਨਾ ਚਾਹੁੰਦਾ ਹੈ ਕਿਉਂਕਿ ਅੱਜ ਕੱਲ੍ਹ ਦੇ ਵਿਆਹ ਉਹ ਵਿਆਹ ਨਹੀਂ ਰਹਿ ਗਏ ਜੋ ਪਿਛਲੇ ਜ਼ਮਾਨੇ ਵਿੱਚ ਹੁੰਦੇ ਸਨ ਅੱਜ ਕੱਲ੍ਹ ਦੇ ਵਿੱਚ ਪ੍ਰੀ ਵੈਡਿੰਗ ਸ਼ੂਟ ਦੇ ਹੀ ਬਹੁਤ ਜ਼ਿਆਦਾ ਪੈਸੇ ਲੈ ਲਿਤੇ ਜਾਂਦੇ ਹਨ ਜੋ ਕਿ ਫਾਨੈਂਸ਼ੀਅਲ ਕੰਡੀਸ਼ਨ ਨੂੰ ਸਹੀ ਰੱਖਣ ਲਈ ਮਦਦ ਕਰਦੇ ਹਨ ਇਸ ਨਾਲ ਮੈਂ ਇਹ ਸੋਚਿਆ ਸੀ ਕਿ ਜੇਕਰ ਮੈਂ ਫੋਟੋਗ੍ਰਾਫ਼ਰ ਬਣਾਂਗਾ ਤਾਂ ਮੇਰਾ ਖਰਚਾ ਆਰਾਮ ਨਾਲ ਨਿਕਲ ਜਾਇਆ ਕਰੇਗਾ ਇਸ ਦੇ ਨਾਲ ਹੀ ਮੇਰਾ ਭਵਿੱਖ ਵੀ ਸੁਧਰੇਗਾ ਅੱਜ ਕੱਲ੍ਹ ਦੇ ਵਿਆਹਾਂ ਵਿੱਚ ਫੋਟੋਗ੍ਰਾਫ਼ੀ ਬਹੁਤ ਹੀ ਜ਼ਿਆਦਾ ਵੱਧ ਚੁੱਕੀ ਹੈ ਹਰ ਇੱਕ ਫੋਟੋਗ੍ਰਾਫ਼ਰ ਬਹੁਤ ਵਧੀਆ ਪੈਸੇ ਲੈਂਦਾ ਹੈ ਤਾਂ ਉਹ ਵਧੀਆ ਐਲਬਮਾਂ ਵੀ ਬਣਾ ਕੇ ਦਿੰਦਾ ਹੈ ਇੱਕ ਫੋਟੋਗ੍ਰਾਫ਼ਰ ਘੱਟੋ ਘੱਟ ਇੱਕ ਵਿਆਹ ਦੇ ਲਈ ਪੰਦਰ੍ਹਾਂ ਤੋਂ ਵੀਹ ਹਜ਼ਾਰ ਰੁਪਈਆ ਲੈਂਦਾ ਹੈ ਅਤੇ ਇੱਕ ਹੀ ਫੋਟੋਗ੍ਰਾਫ਼ਰ ਇੱਕ ਵਿਆਹ ਵਿੱਚ ਨਹੀਂ ਹੁੰਦਾ ਵਿਆਹ ਵਿੱਚ ਤਿੰਨ ਚਾਰ ਫੋਟੋਗ੍ਰਾਫ਼ਰ ਹੁੰਦੇ ਹਨ ਨਾਲ ਹੀ ਨਾਲ ਵੀਡੀਓ ਬਣਾਉਣ ਵਾਲੇ ਵੀ ਹੁੰਦੇ ਹਨ ਫੋਟੋਗ੍ਰਾਫ਼ੀ ਦਾ ਕਰੀਅਰ ਬਹੁਤ ਹੀ ਵਧੀਆ ਹੈ ਅਤੇ ਅੱਜ ਕੱਲ੍ਹ ਦੇ ਸਮੇਂ ਵਿੱਚ ਇਹ ਫੋਟੋਗ੍ਰਾਫ਼ੀ ਬਹੁਤ ਹੀ ਜ਼ਿਆਦਾ ਵਧੀਆ ਪੇਸ਼ਾ ਸਾਬਿਤ ਹੋ ਸਕਦਾ ਹੈ ਕਿਉਂਕਿ ਜਿੱਥੇ ਵੀ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਕੋਈ ਨਾ ਕੋਈ ਵਧੀਆ ਫੋਟੋਗ੍ਰਾਫ਼ਰ ਜ਼ਰੂਰ ਲੱਭ ਹੀ ਜਾਂਦਾ ਹੈ ਉਸ ਨਾਲ ਇਹ ਹੁੰਦਾ ਹੈ ਕਿ ਜਿਹੜੇ ਕਿ ਬਾਕੀ ਹੁੰਦੇ ਹਨ ਉਹਨਾਂ ਵਿੱਚ ਕੋਂਪੀਟੀਸ਼ਨ ਵੱਧ ਜਾਂਦਾ ਹੈ ਜਿਸ ਕਰਕੇ ਛੋਟੇ ਫੋਟੋਗ੍ਰਾਫ਼ਰਾਂ ਨੂੰ ਕੰਮ ਮਿਲਣਾ ਬੰਦ ਹੋ ਜਾਂਦਾ ਹੈ ਜਿਹੜੇ ਤਾਂ ਪ੍ਰੋਫੈਸ਼ਨਲ ਹੁੰਦੇ ਹਨ ਉਹਨਾਂ ਨੂੰ ਲੋਕ ਬਹੁਤ ਹੀ ਜਲਦੀ ਰੱਖ ਲੈਂਦੇ ਹਨ ਅਤੇ ਉਹਨਾਂ ਕੋਲੋਂ ਹੀ ਜ਼ਿਆਦਾ ਫੋਟੋਗ੍ਰਾਫ਼ੀ ਕਰਵਾਉਂਦੇ ਹਨ ਫੋਟੋਗ੍ਰਾਫ਼ੀ ਇੱਕ ਹੋਰ ਸ਼ੂਟ ਵਾਸਤੇ ਵੀ ਬਹੁਤ ਜ਼ਿਆਦਾ ਲਾਭਦਾਇਕ ਬਣ ਚੁੱਕਾ ਹੈ ਅੱਜ ਕੱਲ੍ਹ ਦੇ ਮੁੰਡੇ ਸ਼ੂਟ ਵੀ ਬਹੁਤ ਜ਼ਿਆਦਾ ਕਰਵਾਉਂਦੇ ਹਨ ਅਤੇ ਉਹਨਾਂ ਫੋਟੋਆਂ ਨੂੰ ਇੰਸਟਾਗ੍ਰਾਮ ਉੱਤੇ ਅਪਲੋਡ ਕਰਦੇ ਹਨ ਜਿਸ ਨਾਲ ਉਹਨਾਂ ਨੂੰ ਬਹੁਤ ਸਾਰਾ ਪੈਸਾ ਮਿਲਦਾ ਹੈ ਫੋਟੋਗ੍ਰਾਫ਼ੀ ਇੱਕ ਹੋਰ ਵਾਧੇ ਦਾ ਕੰਮ ਇਸ ਕਰਕੇ ਬਣ ਚੁੱਕਾ ਹੈ ਤਾਂ ਕਿ ਜਿਹੜੇ ਇੰਸਟਾਗ੍ਰਾਮ ਦੇ ਇੰਫਲਐਂਸਰ ਜਾਂ ਯੂਟਿਊਬ ਦੇ ਵੀਡੀਓਗ੍ਰਾਫੀ ਕਰਦੇ ਹਨ ਉਹ ਬਹੁਤ ਜ਼ਿਆਦਾ ਪੈਸੇ ਦਿੰਦੇ ਹਨ ਅਤੇ ਫੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫੀ ਕਰਵਾਉਂਦੇ ਹਨ ਧੰਨਵਾਦ